ਅੱਜ ਕੱਲ੍ਹ ਖ਼ਬਰਾਂ ਦੇ ਬਹੁਤ ਸਾਰੇ ਸ੍ਰੋਤ ਹਨ ਕੋਈ ਸਮਾਂ ਸੀ ਜਦੋਂ ਪੰਜਾਬ ਦੇ ਵਿੱਚ ਜਾਂ ਦੁਨੀਆਂ ਦੇ ਵਿੱਚ ਜਿਹੜੇ ਸੋਸ਼ਲ ਮੀਡੀਆ ਦਾ ਬਹੁਤ ਘੱਟ ਰੋਲ ਸੀ ਉਸ ਸਮੇਂ ਸਿਰਫ਼ ਅਤੇ ਸਿਰਫ਼ ਰੇਡੀਓ ਜਾਂ ਟੈਲੀਵਿਜ਼ਨ ਰਾਹੀਂ ਹੀ ਖ਼ਬਰਾਂ ਪ੍ਰਕਾਸ਼ਿਤ ਹੁੰਦੀਆਂ ਸਨ ਪਰੰਤੂ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਆਉਣ ਨਾਲ਼ ਖ਼ਬਰਾਂ ਦਾ ਜੋ ਪ੍ਰਕਾਸ਼ਨ ਹੈ ਉਹਦੇ ਕਾਫ਼ੀ ਸਾਰੇ ਸ੍ਰੋਤ ਬਣ ਗਏ ਹਨ ਅਖ਼ਬਾਰਾਂ ਟੀ ਵੀ ਰੇਡੀਓ ਪ੍ਰਿੰਟ ਮੀਡੀਆ ਜਾਂ ਸੋਸ਼ਲ ਮੀਡੀਆ ਮਤਲਬ ਕਹਿਣ ਦਾ ਭਾਵ ਬਹੁਤ ਸਾਰੇ ਉਪਕਰਨ ਸਾਡੇ ਅੱਜ ਦੀ ਜ਼ਿੰਦਗੀ ਦੇ ਵਿੱਚ ਸ਼ਾਮਿਲ ਹੋ ਗਏ ਹਨ ਜਿਹਨਾਂ ਦੇ ਨਾਲ਼ ਸਾਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜੋ ਘਟਨਾਵਾਂ ਵਾਪਰਦੀਆਂ ਹਨ ਸਾਨੂੰ ਉਹ ਖ਼ਬਰਾਂ ਮਿੰਟ ਮਿੰਟ ਸਕਿੰਟ ਸਕਿੰਟ ਦੇ ਮੁਤਾਬਿਕ ਉਹ ਸਾਰੀਆਂ ਪ੍ਰਾਪਤ ਹੋ ਰਹੀਆਂ ਹਨ